ਭੰਗੜਾ ਐਰੋਬਿਕਸ ਆਪਣੇ ਪ੍ਰਤੀਭਾਗੀਆਂ ਵਿੱਚ ਰਚਨਾਤਮਕ ਨੂੰ ਬਹੁਤ ਹੀ ਪ੍ਰੇਰਿਤ ਕਰਦਾ ਹੈ ਕਿਉਂਕਿ ਇਹ ਇਹਦੇ ਨਾਲ ਨਾ ਸਰੀਰ ਇੱਕ ਤਾਂ ਬਹੁਤ ਅੱਛਾ ਹੋ ਜਾਂਦਾ ਕਿ ਜਿਹੜੇ ਉਹਦੇ ਮੇਰਾ ਬੇ ਮੇਰਾ ਪੁੱਤਰ ਉਹ ਵੀ ਇਹੋ ਹੀ ਐਰੋਬਿਕਸ ਉਹਨੇ ਕੀਤਾ ਹੋਇਆ ਵੇ ਉਹ ਸਵੇਰੇ ਉੱਠ ਕੇ ਸਾਢੇ ਪੰਜ ਵਜੇ ਜਿਮ ਵਿੱਚ ਜਾਂਦਾ ਵੇ ਅਤੇ ਉੱਥੇ ਆਰੋਬਿਕਸ ਭੰਗੜਾ ਕਰਦਾ ਵੇ ਉਹਦੇ ਸਾਰੇ ਦੋਸਤ ਵੀ ਉਹਦੇ ਨਾਲ ਉਹ ਭੰਗੜਾ ਕਰਦੇ ਨੇ ਅੱਗੇ ਸ਼ੀਸ਼ਾ ਲੱਗਿਆ ਹੁੰਦਾ ਅਤੇ ਲੱਗੇ ਹੁੰਦੇ ਨੇ ਗਾਣੇ ਅਤੇ ਉਹਦੇ ਨਾਲ ਭੰਗੜਾ ਐਰੋਬਿਕਸ ਕਰਦੇ ਨੇ ਉਹਦੇ ਨਾਲ ਉਹਦਾ ਪਹਿਲੇ ਬੜਾ ਜ਼ਿਆਦਾ ਉਹ ਮਤਲਬ ਕਿ ਕੀ ਦੱਸਾਂ ਸੁਸਤ ਜਿਹਾ ਹੁੰਦਾ ਸੀ ਜਦੋਂ ਦਾ ਉਹਨੇ ਇਹ ਕੀਤਾ ਵੇ ਜੋਇਨ ਇਹਦੇ 'ਚ ਭਾਗ ਲਿਆ ਵੇ ਅਤੇ ਉਦੋਂ ਦਾ ਉਹ ਬੜਾ ਹੀ ਵਧੀਆ ਚੁਸਤ ਹੋ ਗਿਆ ਵੇ ਸਾਰੇ ਕੰਮ ਵਿੱਚ ਉਹ ਹੁਣ ਚੁਸਤੀ ਨਾਲ ਕੰਮ ਕਰਦਾ ਵੇ ਕਿਉਂਕਿ ਉਹ ਉਹਦੇ ਨਾਲ ਦੇ ਵੀ ਸਾਰੇ ਦੋਸਤ ਹੁਣ ਉਹਦੇ ਦੋਸਤਾਂ ਦੇ ਜੇ ਫੋਨ ਆਉਂਦੇ ਨੇ ਅਤੇ ਤਾਂ ਵੀ ਇਹੋ ਹੀ ਗੱਲਾਂ ਕਰਦੇ ਹੁੰਦੇ ਨੇ ਉੱਥੇ ਜਾ ਕੇ ਫੋਨ ਦੇ ਵਿੱਚ ਉਹ ਬਣਾ ਕੇ ਲਿਆਂਦਾ ਵੇ ਉਹ ਸਾਰਾ ਅਤੇ ਉਹ ਆ ਕੇ ਮੈਨੂੰ ਵਿਖਾਂਦਾ ਵੇ ਕਿ ਸਾਰੇ ਕਿੰਨਾ ਉੱਥੇ ਖੁਸ਼ ਹੋ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਹਦੇ ਤੋਂ ਬਹੁਤ ਚੰਗੀ ਪ੍ਰੇਰਨਾ ਲਈ ਹੈ ਕਿ ਹਾਂ ਆਪਣਾ ਸਰੀਰ ਵੀ ਠੀਕ ਕਰੋ ਅਤੇ ਇੰਟਰਟੇਨਮੈਂਟ ਵੀ ਕਰੋ